ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਦੱਸੋ ਹਾਂਜੀ ਕਿਹੜੇ ਵਾਲੇ ਮੁੱਦੇ ਆ ਤੁਹਾਡੇ ਅੱਛਾ ਜੀ ਕਿਹੜਾ ਪਿੰਡ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਠੀਕ ਮੈਨੂੰ ਲੱਗ ਗਿਆ ਪਤਾ ਤੁਹਾਡੇ ਪਿੰਡ ਦਾ ਹਾਂਜੀ ਉਹ ਕਮੇਟੀ ਬਣਾ ਰੱਖੀ ਹੈ ਸਰ ਤੁਹਾਡੇ ਪਿੰਡ ਵਾਸਤੇ ਕੰਮ ਹੈ ਪਿੰਡਾਂ ਦੇ ਸਾਰੇ ਪਿੰਡਾਂ ਦੇ ਹੀ ਕੰਮ ਹੋਈ ਜਾਂਦਾ ਹੈ ਬਾਕੀ ਕਮੇਟੀ ਬਣਾ ਰੱਖੀ ਹੈ ਕਿ ਆਹ ਤੁਹਾਡੇ ਪਿੰਡ ਦੀ ਜਿਹੜੀ ਵੀ ਪ੍ਰੋਬਲਮਸ ਆ ਰਹੀ ਬਾਕੀ ਤੁਸੀਂ ਮੈਨੂੰ ਇੱਕ ਵਾਰ ਫਿਰ ਕਨਫਰਮ ਕਰਾ ਦਿਓ ਅੱਛਾ ਜੀ ਅੱਛਾ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਮੈਂ ਸਮਝ ਗਈ ਤੁਹਾਡੀ ਗੱਲ ਬਸ ਉੱਥੇ ਵੀ ਅਵੇਅਰਨੈਸ ਤੁਹਾਨੂੰ ਦੇਣੀ ਪਵੇਗੀ ਜੀ ਉੱਥੇ ਗੰਦ ਨਾ ਸੁੱਟੋ ਜਾ ਸੜਕਾਂ 'ਤੇ ਇੱਦਾਂ ਦਾ ਬਾਕੀ ਕਰਦੇ ਹਾਂ ਕੰਮ ਨਹੀਂ ਨਹੀਂ ਸਰ ਅਸੀਂ ਅੱਜ ਹੀ ਕਮ ਬੁਲਾਉਂਦੇ ਹਾਂ ਜਿਹੜੀ ਕਮੇਟੀ ਬਣੀ ਹੋਈ ਹੈ ਉਹਨੂੰ ਅੱਜ ਹੀ ਅਸੀਂ ਬੁਲਾ ਕੇ ਅਤੇ ਮੀਟਿੰਗ ਕਰਦੇ ਹਾਂ ਸ਼ਾਮ ਨੂੰ ਅਤੇ ਤੁਹਾਡੇ ਹੀ ਪ੍ਰੋਬਲਮ ਤਾਂ ਜਲਦੀ ਹੱਲ ਕਰਦੇ ਹਾਂ ਹਾਂਜੀ ਦੱਸੋ

ਹਾਂਜੀ ਹਾਂਜੀ ਹਾਂਜੀ ਦੇਖ ਬੱਚੇ ਲੜਦੇ ਆਪਸ 'ਚ ਜਾਂ ਸਕੂਲ ਵਾਲਿਆਂ ਨਾਲ ਪਿੰਡ ਵਾਲੇ ਅੱਛਾ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਅਸੀਂ ਤੁਹਾਡੇ ਪ੍ਰੋਬਲਮਸ ਨੋਟ ਕਰ ਲਈਆਂ ਨੇ ਅਤੇ ਬਾਕੀ ਜਲਦ ਤੋਂ ਜਲਦ ਇਹਦਾ ਆਪਾਂ ਕਵਾਂ ਕਰਾਂਗੇ ਇਨਵਰਨ ਅਤੇ ਹਾਂਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਓਕੇ ਜੀ ਓਕੇ